ਸਲਵਾਰ ਸੂਟ ਦੱਖਣੀ ਏਸ਼ੀਆ ਵਿੱਚ ਰਵਾਇਤੀ ਫੈਸ਼ਨ ਦਾ ਅਨਿਖੜਵਾਂ ਅੰਗ ਹਨ ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ਪੰਜਾਬੀ ਸਲਵਾਰ ਸੂਟ ਸ਼ੈਲੀ ਵਿੱਚ ਇੱਕ ਛੋਟਾ ਕੁੜਤਾ ਅਤੇ ਇੱਕ ਪਟਿਆਲਾ ਸਲਵਾਰ ਹੈ ਇਹ ਇੱਕ ਕਿਸਮ ਦੀ ਪੈਂਟ ਹੈ ਜੋ ਇਸਦੇ ਪਲੇਟਾਂ ਅਤੇ ਵਿਸ਼ਾਲ ਸਲਿਊਟ ਦੁਆਰਾ ਦਰਸਾਏ ਜਾਂਦੀ ਹੈ ਇਸ ਦੀਆਂ ਕਈ ਕਿਸਮਾਂ ਹਨ ਜਿਵੇਂ ਕਿ ਸਟਰੇਟ ਕੱਟ ਸਲਵਾਰ ਸੂਟ ਅਫਗਾਨੀ ਸੂਟ ਧੋਤੀ ਸਟਾਈਲ ਪੰਜਾਬੀ ਸੂਟ ਪਠਾਨੀ ਸੂਟ ਪਲਾਜੋ ਸਲਵਾਰ ਸੂਟ ਪਾਕਿਸਤਾਨੀ ਸਟਾਈਲ ਸਲਵਾਰ ਸੂਟ ਸ਼ਰਾਰਾ ਸਟਾਈਲ ਸਲਵਾਰ ਸੂਟ ਸਟਰੇਟ ਕੱਟ ਸਲਵਾਰ ਸੂਟ ਇੱਕ ਸ਼ਾਨਦਾਰ ਸਲਵਾਰ ਸੂਟ ਹੈ ਜਿਸ ਵਿੱਚ ਇੱਕ ਲੰਮਾ ਸਿੱਧਾ ਕੁੜਤਾ ਹੈ ਜੋ ਗੋਡਿਆਂ ਜਾਂ ਹੇਠਾਂ ਤੱਕ ਫੈਲਿਆ ਹੋਇਆ ਹੈ ਇਹ ਆਮ ਤੌਰ 'ਤੇ ਚੂੜੀਦਾਰ ਤਲ ਦੇ ਨਾਲ ਜੋੜਿਆ ਜਾਂਦਾ ਹੈ ਇੱਕ ਕਿਸਮ ਦਾ ਟਾਈਟ ਫਿਟਿੰਗ ਟਰਾਊਜਰ ਜਿਸਦੇ ਗਿੱਟੇ 'ਤੇ ਇਕੱਠੇ ਹੁੰਦੇ ਹਨ ਅਫਗਾਨੀ ਸਟਾਈਲ ਸੂਟ ਵਿੱਚ ਇੱਕ ਚੌੜਾ ਪਲੇਟਿਡ ਬੋਟਮ ਇੱਕ ਪਤਲਾ ਛੋਟਾ ਕੁੜਤਾ ਹੈ ਇਹ ਇੱਕ ਬੋਲਡ ਅਤੇ ਸਟਾਈਲਿਸ਼ ਵਿਕਲਪ ਹੈ ਜੋ ਆਪਣੇ ਵਿਲੱਖਣ ਸਲਿਊ ਸਲੀਵੇਟ ਨਾਲ ਜਾਣਿਆ ਜਾਂਦਾ ਹੈ ਧੋਤੀ ਸਟਾਈਲ ਸਲਵਾਰ ਸੂਟ ਇੱਕ ਰਵਾਇਤੀ ਧੋਤੀ ਪਹਿਰਾਵੇ ਤੋਂ ਪ੍ਰੇਰਿਤ ਹੈ ਇਸ ਸੂਟ ਵਿੱਚ ਸਲਵਾਰ ਧੋਤੀ ਵਰਗੀ ਹੋਣ ਲਈ ਡਰੈਪ ਅਤੇ ਪਲੇਟ ਕੀਤੀ ਗਈ ਹੈ ਜੋ ਇੱਕ ਸਟਾਈਲਿਸ਼ ਦਿਖ ਦਿੰਦੀ ਹੈ ਇਸ ਨੂੰ ਅਕਸਰ ਛੋਟੇ ਜਾਂ ਗੋਡਿਆਂ ਤੱਕ ਲੰਬਾਈ ਵਾਲੇ ਕੁੜਤੇ ਨਾਲ ਜੋੜਿਆ ਜਾਂਦਾ ਹੈ ਪਠਾਣੀ ਸੂਟ ਪਠਾਣ ਦੇ ਲੋਕਾਂ ਦੇ ਨਾਂ 'ਤੇ ਰੱਖਿਆ ਗਿਆ ਇਸ ਸਟਾਈਲ ਵਿੱਚ ਇੱਕ ਢਿੱਲਾ ਅਤੇ ਲੰਬਾ ਕੁੜਤਾ ਹੈ ਜੋ ਸਲਵਾਰ ਦੇ ਨਾਲ ਹੈ ਜੋ ਉੱਪਰੋਂ ਢਿੱਲਾ ਅਤੇ ਹੇਠਾਂ ਤੰਗ ਹੈ ਇਹ ਇੱਕ ਆਰਾਮਦਾਇਕ ਅਤੇ ਆਮ ਸਟਾਈਲ ਹੈ ਜੋ ਰੋਜ਼ਾਨਾ ਪਹਿਨਣ ਲਈ ਸੰਪੂਰਨ ਹੈ ਪਲਾਜੋ ਸਲਵਾਰ ਸੂਟ ਵਿੱਚ ਇੱਕ ਸਿੱਧੇ ਕੁੜਤੇ ਨੂੰ ਚੌੜੀਆਂ ਲੱਤਾਂ ਵਾਲੇ ਪਲਾਜੋ ਪੈਂਟਾ ਨਾਲ ਜੋੜਿਆ ਗਿਆ ਹੈ ਪਾਕਿਸਤਾਨੀ ਸਲ ਸਟਾਈਲ ਸਲਵਾਰ ਸੂਟ ਇੱਕ ਵਿਲੱਖਣ ਅਤੇ ਸ਼ਾਨਦਾਰ ਪਹਿਰਾਵਾ ਹੈ ਜਿਸ ਵਿੱਚ ਸਿੱਧੀਆਂ ਪੈਂਟਾਂ ਵੱਖ ਵੱਖ ਲੰਬਾਈਆਂ ਦੀਆਂ ਕੁੜਤੀਆਂ ਦੇ ਨਾਲ ਮਿਲਦੀਆਂ ਹਨ ਸ਼ਰਾਰਾ ਸਟਾਈਲ ਸਲਵਾਰ ਸੂਟ ਵਿੱਚ ਇੱਕ ਸਾਦਾ ਅਤੇ ਵਾਧੂ ਫਲੇਅਰਡ ਸ਼ਰਾਰਾ ਇੱਕ ਕਿਸਮ ਦੀ ਚੌੜੀ ਲੱਤਾਂ ਵਾਲੀ ਪੈਂਟ ਹੈ